ਭਾਰਤ ਵਿੱਚ ਇੱਕ ਬਹੁਤ ਹੀ ਮਸ਼ਹੂਰ ਯੋਗਾ ਗੁਰੂ ਹਨ ਉਹਨਾਂ ਦਾ ਨਾਮ ਹੈ ਗੁਰੂ ਦੇਵ ਰਾਮਦੇਵ ਅਤੇ ਉਹ ਬਹੁਤ ਹੀ ਜ਼ਿਆਦਾ ਯੋਗਾ ਕਰਦੇ ਹਨ ਅਤੇ ਬਹੁਤ ਹੀ ਜ਼ਿਆਦਾ ਭਾਰਤ ਦੇ ਵਾਸੀ ਉਹਨਾਂ ਨੂੰ ਉਹਨਾਂ ਦੇ ਮਗਰ ਵੀ ਲੱਗ ਗਏ ਹਨ ਯੋਗਾ ਕਰਦੇ ਹਨ ਜੋ ਕਿ ਯੋਗਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਸਿਹਤ ਲਈ ਤੇ ਜਦੋਂ ਮੈਂ ਸ਼ੁਰੂ ਸ਼ੁਰੂ ਚ ਦੇਖਣ ਲੱਗਿਆ ਤਾਂ ਮੈਨੂੰ ਬਹੁਤ ਹੀ ਕਠਿਨ ਆਸਨ ਲੱਗੇ ਬਹੁਤ ਹੀ ਮੇਰਾ ਧਿਆਨ ਨਹੀਂ ਲੱਗਦਾ ਸੀਗਾ ਫਿਰ ਉਹਨਾਂ ਨੇ ਚਲੋ ਮੈਂ ਫਿਰ ਵੀ ਉਨ੍ਹਾਂ ਨੂੰ ਦੇਖਦਾ ਗਿਆ ਟੀ ਵੀ 'ਤੇ ਫਿਰ ਮੈਨੂੰ ਉਨ੍ਹਾਂ ਨੇ ਇੱਕ ਆਸਨ ਦੱਸਿਆ ਸੀਗਾ ਟੀ ਵੀ ਤੇ ਉਹ ਧਿਆਨ ਆਸਨ ਫਿਰ ਉਹ ਮੈਂ ਸ਼ੁਰੂ ਸ਼ੁਰੂ ਸ਼ੁਰੂ 'ਚ ਮੈਨੂੰ ਉਹ ਵੀ ਕਠਿਨ ਲੱਗਿਆ ਸੀਗਾ ਪਰ ਮੈਂ ਇੱਕੀ ਦਿਨ ਉਹਨਾਂ ਨੇ ਕਿਹਾ ਸੀਗਾ ਲਗਾਤਾਰ ਕਰਨਾ ਇੱਕੀ ਦਿਨ ਮਗਰੋਂ ਫਿਰ ਮੈਨੂੰ ਬਹੁਤ ਹੀ ਜ਼ਿਆਦਾ ਉਹ ਅਸਾਨ ਲੱਗਣ ਲੱਗਾ ਫਿਰ ਮੈਂ ਉਨ੍ਹਾਂ ਦੇ ਹਰੇਕ ਆਸਨ ਨੂੰ ਫੋਲੋ ਕਰ ਰਿਹਾਂ ਹਾਂ ਉਦੋਂ ਦਾ ਹੀ ਅਤੇ ਮੇਰੀ ਸਿਹਤ ਫੁੱਲਾਂ ਵਾਗੂੰ ਖਿੜਦੀ ਰਹਿੰਦੀ ਹੈ ਮੈਂ ਕਦੇ ਬਿਮਾਰ ਨਹੀਂ ਹੁੰਦਾ ਹੈਗਾ ਸਵੇਰੇ ਮੈਂ ਦੋ ਘੰਟੇ ਯੋਗੇ 'ਚ ਕਰਦਾ ਹਾਂ